ਪਹਿਲਾਂ ਮੇਰੇ ਪਿੰਡ ਬਿਲਕੁਲ ਵੀ ਬੱਸਾਂ ਨਹੀਂ ਆਉਂਦੀਆਂ ਸਨ ਬਹੁਤ ਹੀ ਘੱਟ ਬੱਸਾਂ ਆਉਂਦੀਆਂ ਸਨ ਅਤੇ ਜਦੋਂ ਵੀ ਬੱਸਾਂ ਆਉਂਦੀਆਂ ਸਨ ਉਹ ਭਰੀਆਂ ਰਹਿੰਦੀਆਂ ਸਨ ਸਵਾਰੀਆਂ ਨਾਲ ਸਾਡੇ ਪਿੰਡ ਦੀਆਂ ਬਜ਼ੁਰਗ ਔਰਤਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਅਤੇ ਛੋਟੇ ਛੋਟੇ ਬੱਚੇ ਵੀ ਜਿਨ੍ਹਾਂ ਨੇ ਕਿਤੇ ਜਾਣਾ ਹੁੰਦਾ ਸੀ ਉਹ ਬੱਸ ਨੂੰ ਉਡੀਕਦੇ ਰਹਿੰਦੇ ਸੀਗੇ ਬੱਸਾਂ ਬਹੁਤ ਘੱਟ ਆਉਂਦੀਆਂ ਸੀ ਉਹ ਪੂਰੀਆਂ ਭਰੀਆਂ ਰਹਿੰਦੀਆਂ ਸੀ ਪਹਿਲਾਂ ਸਾਡੇ ਪਿੰਡ ਟੈਂਪੂ ਚੱਲਦੇ ਹੁੰਦੇ ਸੀ ਹੁਣ ਹਰੇਕ ਦੇ ਘਰ ਮੋਟਰਸਾਈਕਲ ਅਤੇ ਕਾਰਾਂ ਹਨ ਇਹਦੇ ਨਾਲ ਬੱਸਾਂ ਦੀ ਅਤੇ ਟੈਂਪੂਆਂ ਦੀ ਆਵਾਜਾਈ ਬਹੁਤ ਜ਼ਿਆਦਾ ਘੱਟ ਹੋ ਗਈ ਹੈ ਇਸ ਨਾਲ ਬੱਸਾਂ ਦੀ ਆਵਾਜਾਈ ਬਹੁਤ ਹੀ ਜ਼ਿਆਦਾ ਘੱਟ ਗਈ ਹੈ ਸਾਡੇ ਪਿੰਡ ਹੁਣ ਬਹੁਤ ਹੀ ਘੱਟ ਬੱਸਾਂ ਆਉਂਦੀਆਂ ਹਨ ਕਿਉਂਕਿ ਹਰੇਕ ਦੇ ਘਰ ਇੱਕ ਹਰੇਕ ਦੇ ਘਰ ਦੋ ਦੋ ਜਾਂ ਤਿੰਨ ਤਿੰਨ ਮੋਟਰਸਾਈਕਲ ਹੁੰਦੇ ਹਨ ਇਸ ਲਈ ਬੱਸਾਂ ਦੀ ਆਵਾਜਾ ਆਵਾ ਆਵਾਜਾਈ ਬਹੁਤ ਜ਼ਿਆਦਾ ਘੱਟ ਹੋ ਗਈ ਹੈ ਹੁਣ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਦੇ ਸਮੇਂ ਵਿੱਚ ਹੁਣ ਜੋ ਬਜ਼ੁਰਗ ਔਰਤਾਂ ਬੱਚੇ ਜਾਂ ਹੋਰ ਵੀ ਕੋਈ ਕਈ ਲੋਕ ਤੁਰ ਕੇ ਕਿਤੇ ਨਾ ਕਿਤੇ ਜਾਂਦੇ ਹੁੰਦੇ ਸੀ ਕਿਉਂਕਿ ਬੱਸਾਂ ਆਉਂਦੀਆਂ ਹੀ ਨਹੀਂ ਸੀ ਉਹ ਸਾਰਾ ਟੈਮ ਭਰੀਆਂ ਰਹਿੰਦੀਆਂ ਸੀ ਹੁਣ ਅੱਜ ਕੱਲ੍ਹ ਲੋਕ ਕੀ ਕਰਦੇ ਹਨ ਮੋਟਰਸਾਈਕਲ ਚੱਕਦੇ ਹਨ ਆਪਣਾ ਨਿਕਲ ਜਾਂਦੇ ਹਨ ਇਸ ਨਾਲ ਆਵਾਜਾਈ ਬਹੁਤ ਜ਼ਿਆਦਾ ਹੋ ਗਈ ਆ ਅਤੇ ਐਕਸੀਡੈਂਟ ਦੇ ਕਾਰਨ ਬਹੁਤ ਵੱਧ ਗਏ ਹਨ ਧੰਨਵਾਦ